ਸਿਲਾਈ ਮਸ਼ੀਨਾਂ ਬਹੁਤ ਪ੍ਰਕਾਰ ਦੀਆਂ ਹੁੰਦੀਆਂ ਹਨ ਜਿਵੇਂ ਕਿ ਹੱਥ ਵਾਲੀ ਮਸ਼ੀਨ ਪੈਰਾਂ 'ਤੇ ਚੱਲਣ ਵਾਲੀ ਮਸ਼ੀਨ ਮੋਟਰ 'ਤੇ ਚੱਲਣ ਵਾਲੀ ਮਸ਼ੀਨ ਹੋਰ ਵੀ ਬਹੁਤ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ ਹਨ ਪਿੰਡਾਂ ਵਿੱਚ ਇਹਨਾਂ 'ਤੇ ਸਿਲਾਈ ਕਰਕੇ ਕੱਪੜੇ ਸੀ ਕੇ ਲੋਕ ਰੁਜ਼ਗਾਰ ਕਮਾ ਰਹੇ ਹਨ ਆਮ ਤੌਰ 'ਤੇ ਪਿੰਡਾਂ ਵਿੱਚ ਇਹ ਮਸ਼ੀਨਾਂ ਹੱਥ ਵਾਲੀਆਂ ਮਸ਼ੀਨਾਂ ਹੀ ਚੱਲਦੀਆਂ ਹਨ ਸ਼ਹਿਰਾਂ ਦੇ ਵਿੱਚ ਮਸ਼ੀਨਾਂ ਮੋਟਰ 'ਤੇ ਮਸ਼ੀ ਮਸ਼ੀਨ ਜਿਹੜੀ ਚਲਦੀ ਉਸ 'ਤੇ ਲੋਕ ਕਮਾਈ ਕਰ ਰਹੇ ਹਨ ਜਿਵੇਂ ਕਿ ਪੈਂਟਾਂ ਗਾਤਰੇ ਬੈਗ ਆਦਿ ਸੀਨਾ ਬੈਗ ਆ ਜਿਹੜੇ ਬੈਗ ਆਪਾਂ ਨੂੰ ਮਸ਼ੀਨਾਂ ਤੋਂ ਸਿਲਾਈ ਕੀਤੇ ਮਿਲਦੇ ਘਰ ਦੇ ਮਿਲਦੇ ਹਨ ਉਹ ਬਹੁਤ ਵਧੀਆ ਹੁੰਦੇ ਹਨ ਬਹੁਤ ਟਾਈਮ ਕੱਢ ਜਾਂਦੇ ਹਨ ਸਾਡੇ ਘਰ ਹੱਥ ਵਾਲੀ ਮਸ਼ੀਨ ਹੈ ਅਸੀਂ ਆਪਣੇ ਕੱਪੜੇ ਹੱਥ ਵਾਲੀ ਮਸ਼ੀਨ ਨਾਲ ਸਿਉਂ ਸਕਦੇ ਹਾਂ